ਸਤਿ ਸ਼੍ਰੀ ਅਕਾਲ ਜੀ ਸਰ ਮੈਂ ਤੁਹਾਡੀ ਵੈੱਬਸਾਈਟ ਤੋਂ ਇੱਕ ਹਫ਼ਤਾ ਪਹਿਲਾਂ ਮੋਬਾਈਲ ਮੰਗਵਾਇਆ ਸੀ ਜੋ ਮੈਨੂੰ ਹਫ਼ਤੇ ਦੇ ਵਿੱਚ ਵਿੱਚ ਰੀਸੀਵ ਹੋ ਗਿਆ ਸੀ ਅਤੇ ਮੈਂ ਜਦੋਂ ਇਹ ਡੱਬਾ ਅਨਬੋਕਸ ਕੀਤਾ ਹੈ ਤਾਂ ਪਹਿਲਾ ਤਾਂ ਮੈਨੂੰ ਇਹਦਾ ਲੁੱਕ ਬਹੁਤ ਵਧੀਆ ਮਤਲਬ ਉਹ ਲੱਗੀ ਹੈ ਮੋਬਾਈਲ ਦੀ ਅਤੇ ਟੱਚ ਬਹੁਤ ਸਮੂਥਲੀ ਚੱਲ ਰਿਹਾ ਨੈੱਟਵਰਕ ਦਾ ਕੋਈ ਇਸ਼ੂ ਨਹੀਂ ਹੈ ਸਪੀਕਰਾਂ ਦੀ ਅਵਾਜ਼ ਜਿਵੇਂ ਔਨਲਾਈਨ ਦਿਖਾਇਆ ਸੀ ਉਦਾਂ ਦੀ ਹੀ ਅਵਾਜ਼ ਹੈ ਜੀ

ਕੈਮਰਾ ਦੀ ਕਲੈਅਰਟੀ ਬਹੁਤ ਜ਼ਿਆਦਾ ਹੈ ਕੈਮਰੇ ਬਹੁਤ ਵਧੀਆ ਹੈ ਜੀ ਕੈਮਰਿਆਂ ਕਰਕੇ ਮੈਂ ਫ਼ੋਨ ਮੰਗਵਾਇਆ ਸੀ ਮੈਂ ਇਸ ਤੋਂ ਬਹੁਤ ਸੰਤੁਸ਼ਟ ਹਾਂ ਜੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਤੁਹਾਡਾ